ਪਿੰਡ ਜਿਹਦਾ ਕਿ ਦੂਜਾ ਨਾਂ ਹੀ ਸਕੂਨ ਹੈ ਪਿੰਡ ਵਿੱਚ ਜਾ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਜਿੰਨੇ ਵੀ ਥਕਾਵਟ ਵਗੈਰਾ ਜਾਂ ਦਰਦ ਵਗੈਰਾ ਉਹ ਸਭ ਹਟ ਜਾਂਦਾ ਹੈ ਪਿੰਡ ਦਾ ਸ਼ੁੱਧ ਵਾਤਾਵਰਨ ਹਵਾ ਲੋਕ ਮਿੱਠੀ ਬੋਲੀ ਅਤੇ ਜ਼ਮੀਨ ਨਾਲ ਜੁੜੇ ਲੋਕ ਬਹੁਤ ਚੀਜ਼ਾਂ ਪਿਆਰੀਆਂ ਨੇ ਪਿੰਡਾਂ ਵਿੱਚ ਜਾਣ ਦਾ ਮੇਰਾ ਮਕਸਦ ਇਹੀ ਹੁੰਦਾ ਹੈ ਕਿ ਮੈਂ ਜਾ ਕੇ ਆਪਣੇ ਸਾਰੀ ਜੋ ਵੀ ਦਿਨ ਦੀ ਥਕਾਵਟ ਵਗੈਰਾ ਹੈ ਉਹ ਸਭ ਹਟਾ ਲਾ ਪਿੰਡ ਵਿੱਚ ਮੈਂ ਜ਼ਿਆਦਾਤਰ ਦੋ ਤਿੰਨ ਦਿਨ ਤੋਂ ਬਾਅਦ ਗੇੜਾ ਮਾਰੀ ਜਾਂਦਾ ਹਾਂ ਕਿਉਂਕਿ ਮੇਰੇ ਦਾਦਕੇ ਨਾਨਕੇ ਸਭ ਪਿੰਡਾਂ ਵਿੱਚ ਹੀ ਨੇ ਬਟ ਬਾਪੂ ਦੀ ਨੌਕਰੀ ਸ਼ਹਿਰ 'ਚ ਹੋਣ ਕਾਰਨ ਮੈਨੂੰ ਸ਼ਹਿਰ 'ਚ ਰਹਿਣਾ ਪੈਂਦਾ ਹੈ ਜ਼ਿਆਦਾਤਰ ਬਟ ਮੈਨੂੰ ਜਦੋਂ ਵੀ ਮੌਕਾ ਮਿਲਦਾ ਹੈ ਮੈਂ ਪਿੰਡ ਜ਼ਰੂਰ ਜਾਂਦਾ ਹਾਂ ਅਤੇ ਸ਼ੁੱਧ ਵਾਤਾਵਰਨ ਅਤੇ ਸ਼ੁੱਧ ਹਵਾ ਦਾ ਭਰਪੂਰ ਆਨੰਦ ਲੈਂਦਾ ਹਾਂ ਮੈਨੂੰ ਪਿੰਡ ਦੇ ਲੋਕ ਅਤੇ ਆਪਣੇ ਪਿੰਡ ਦੇ ਦੋਸਤ ਬਹੁਤ ਪਸੰਦ ਨੇ ਕਿਉਂਕਿ ਉਹ ਮੈਨੂੰ ਜ਼ਮੀਨ ਨਾਲ ਜੁੜੀਆਂ ਗੱਲਾਂ ਸਿਖਾਉਂਦੇ ਨੇ ਪਿੰਡ ਦੀਆਂ ਖੇਡਾਂ ਜਿਵੇਂ ਕਿ ਕਬੱਡੀ ਹਾਕੀ ਇੰਟਰਨੈਸ਼ਨਲ ਲੈਵਲ ਤੱਕ ਵੀ ਹੈ ਨੇ ਅਤੇ ਬਹੁਤ ਮਜ਼ਾ ਆਉਂਦਾ ਇਹਨਾਂ ਨੂੰ ਖੇਡਣ 'ਤੇੇ ਇਹਨਾਂ ਨੂੰ ਦੇਖਣ 'ਤੇ ਅਤੇ ਸਾਡੇ ਪਿੰਡ ਦੇ ਕਈ ਨੌਜਵਾਨ ਵੀ ਇੰਟਰਨੈਸ਼ਨਲ ਓਲੰਪਿਕਸ ਤੱਕ ਖੇਲ ਕੇ ਆਏ ਹੋਏ ਨੇ ਉਹਨਾਂ ਨੂੰ ਮਿਲ ਕੇ ਨਵੀਂ ਨਵੀਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਪਿੰਡ 'ਚ ਬਜ਼ੁਰਗ ਸਾਨੂੰ ਇਹੋ ਜਿਹੀਆਂ ਗੱਲਾਂ ਦੱਸਦੇ ਨੇ ਜੋ ਕਿ ਸਾਨੂੰ ਕਦੇ ਕਿਤੇ ਹੋਰ ਕਿਤਾਬਾਂ 'ਚ ਫੋਨਾਂ 'ਚ ਨਹੀਂ ਮਿਲ ਸਕਦੀਆਂ ਪਿੰਡ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਜਾ ਕੇ ਵੱਡੇ ਤੋਂ ਵੱਡਾ ਸਕੂਨ ਸਭ ਮਿਲਦਾ ਹੈ ਪਿੰਡਾਂ ਪਰ ਅੱਜ ਕੱਲ੍ਹ ਬਹੁਤ ਜ਼ਿਆਦਾ ਪਿੰਡ ਘੱਟਦੇ ਜਾ ਰਹੇ ਕਿਉਂਕਿ ਲੋਕ ਪੈਸੇ ਕਰਕੇ ਬਾਹਰਲੇ ਮੁਲਖਾਂ ਵਿੱਚ ਜਾ ਰਹੇ ਨੇ ਸਾਨੂੰ ਵੱਧ ਤੋਂ ਵੱਧ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਮੀਨ ਨਾਲ ਜੁੜ ਕੇ ਰਹੀਏ ਤਾਂ ਜੋ ਕਿ ਬਾਹਰਲਾ ਦੇਸ਼ ਕੱਲ੍ਹ ਨੂੰ ਹਾਡੇ ਦੇਸ਼ ਨੂੰ ਹੜਪ ਨਾ ਸਕੇ ਪਿੰਡਾਂ ਪਿੰਡ ਏ ਆ ਪਿੰਡ ਪਿੰਡ ਹੈ ਯਾਰ ਪਿੰਡ ਵਰਗੀ ਕੋਈ ਰੀਸ ਨਹੀਂ ਕਿਤੇ